ਹੈਲੋ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ ਬੋਲ਼ਦੇ ਹੋ ਡੋਮੀਨੋਜ਼ ਤੋਂ ਮੈਂ ਸ਼ਿਵਾਨੀ ਗੱਲ ਕਰਦੀ ਹਾਂ ਗਾਂਧੀ ਨਗਰ ਤੋਂ ਹਾਂਜੀ ਮੈਂ ਨਾ ਹੁਣ ਦੁਪਹਿਰ ਨੂੰ ਔਨਲਾਈਨ ਖਾਣ ਵਾਲਾ ਸਮਾਨ ਮੰਗਵਾਇਆ ਸੀ ਦੋ ਬਰਗਰ ਵਨ ਬਿੱਗ ਪਿੱਜ਼ਾ ਇੱਕ ਪਲੇਟ ਫਰੈਂਚ ਫਰਾਈਜ਼ ਇੱਕ ਪਲੇਟ ਪਾਸਤਾ ਔਰ ਇੱਕ ਕੋਲਡ ਡਰਿੰਕ ਮੰਗਵਾਈ ਸੀ ਅਤੇ ਹੁਣ ਮੈਂ ਤੁਹਾਨੂੰ ਉਹ ਦੁਬਾਰਾ ਮੈਨਿਊ ਦੱਸ ਦਿੰਦੀ ਹਾਂ ਅਤੇ ਤੁਸੀਂ ਉਹ ਭੇਜ ਦਿਉ ਦੋ ਬਰਗਰ ਇੱਕ ਬਿੱਗ ਪਿੱਜ਼ਾ ਇੱਕ ਪਲੇਟ ਫਰੈਂਚ ਫਰਾਈਜ਼ ਇੱਕ ਪਲੇਟ ਪਾਸਤਾ ਔਰ ਇੱਕ ਪਲੇਟ ਕੋਲਡ ਡਰਿੰਕ ਦੀ ਹਾਂਜੀ ਥੈਂਕ ਯੂ